ਬੀਬੀ ਰਜਿੰਦਰ ਕੌਰ ਅਤੇ ਬੀਬੀ ਪ੍ਰੀਤਮ ਕੌਰ ਵਰਗੀਆਂ ਔਰਤਾਂ ਨੇ ਭਾਰਤ ਸੁਤੰਤਰ ਸੰਗਰਾਮ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਬੀਬੀ ਰਜਿੰਦਰ ਕੌਰ ਇੱਕ ਭਾਰਤੀ ਸਿਆਸਤਦਾਨ ਜਿਨਾਂ ਨੇ ਇੱਕੀ ਨਵੰਬਰ ਉੱਨੀ ਸੋ ਛਿਆਨਵੇਂ ਤੋਂ ਗਿਆਰਾਂ ਫਰਵਰੀ ਉੱਨੀ ਸੋ ਸਤਾਨਵੇਂ ਤੱਕ ਪੰਜਾਬ ਦੀ ਚੋਦਵੀਂ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਭਾਰਤੀ ਰਾਸ਼ਟਰ ਕਾਂਗਰਸ ਦੀ ਉਹ ਸਦੱਸਿਆ ਸਨ ਉਹ ਪੰਜਾਬ ਦੀ ਪਹਿਲੀ ਅਤੇ ਭਾਰਤ ਦੀ ਅੱਠਵੀਂ ਮਹਿਲਾ ਮੁੱਖ ਮੰਤਰੀ ਸੀ ਉਹਨਾਂ ਨੇ ਛੇ ਜਨਵਰੀ ਦੋ ਹਜਾਰ ਚਾਰ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਪੰਜਾਬ ਦੀ ਦੂਸਰੀ ਉਪ ਮੁੱਖ ਮੰਤਰੀ ਵੱਜੋਂ ਸੇਵਾ ਨਿਭਾਈ ਉੱਨੀ ਸੋ ਚੁਰਾਨਵੇਂ ਵਿੱਚ ਬੀਬੀ ਰਜਿੰਦਰ ਕੌਰ ਚੰਡੀਗੜ੍ਹ ਵਿੱਚ ਰਾਜ ਦੇ ਸਿੱਖਿਆ ਮੰਤਰੀ ਰਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਬਣੀ ਜਦੋਂ ਉਸਨੇ ਹਰਚਰਨ ਸਿੰਘ ਬਰਾੜ ਦੇ ਅਸਤੀਫੇ ਤੋਂ ਬਾਅਦ ਅਹੁਦਾ ਸੰਭਾਲਿਆ ਨਵੰਬਰ ਉੱਨੀ ਸੋ ਛਿਆਨਵੇਂ ਤੋਂ ਫਰਵਰੀ ਉੱਨੀ ਸੋ ਸਤਾਨਵੇਂ ਤੱਕ ਭਾਰਤੀ ਇਤਿਹਾਸ ਦੀ ਅੱਠਵੀਂ ਮਹਿਲਾ ਮੁੱਖ ਮੰਤਰੀ ਬਣੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਹਨਾਂ ਦੀਆਂ ਪਹਿਲੀਆਂ ਕਦਮੀਆਂ ਵਿੱਚ ਦਸੰਬਰ ਉੱਨੀ ਸੋ ਛਿਆਨਵੇਂ ਵਿੱਚ ਛੋਟੀ ਖੂਹਾਂ ਨੂੰ ਬਿਜਲੀ ਤੇ ਖੂਹਾਂ ਦੀ ਬਿਜਲੀ ਮੁਫਤ ਬਿਜਲੀ ਦੀ ਕਰੰਟ ਪ੍ਰਦਾਨ ਕਰਨ ਦੀ ਯੋਜਨਾ ਬਣਾਈ ਫਰਵਰੀ ਉੱਨੀ ਸੋ ਸਤਾਨਵੇਂ ਵਿੱਚ ਪੰਜਾਬ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹਾਰਨ ਤੋਂ ਬਾਅਦ ਭੱਠਲ ਨੇ ਮਈ ਚ ਸਿੰਘ ਰੰਧਾਵਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਿਰ ਕਾਂਗਰਸ ਦੇ ਨੇਤਾ ਵਜੋਂ ਅਹੁਦਾ ਸੰਭਾਲਿਆ ਵਿਧਾਨ ਸਭਾ ਪਾਰਟੀ ਅਕਤੂਬਰ ਉੱਨੀ ਸੋ ਅਠਾਨਵੇਂ ਤੱਕ ਜਦੋਂ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਚੌਧਰੀ ਜਗਜੀਤ ਸਿੰਘ ਨੇ ਉਸ ਦੀ ਥਾਂ ਸੰਭਾਲੀ ਕਾਂਗਰਸ ਦੀ ਲੀਡਰਸ਼ਿਪ ਦੀ ਸ਼ਮੂਲੀਅਤ ਬਾਰੇ ਬਿਆਨਾਂ ਦੇ ਦਾਵਿਆਂ ਦੇ ਬਾਵਜੂਦ ਉਸ ਤੋਂ ਬਾਅਦ ਅਮਰਿੰਦਰ ਸਿੰਘ ਨਾਲ ਇੱਕ ਲੰਮਾ ਵਿਵਾਦ ਹੋਇਆ ਜਿਸ ਨੂੰ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਅਤੇ ਉਸ ਨੂੰ ਹਟਾਉਣ ਦੀ ਜਿੰਮੇਵਾਰੀ ਮੰਨਿਆ ਜਾਂਦਾ ਹੈ ਦੋ ਹਜਾਰ ਤਿੰਨ ਤੱਕ ਭੱਠਲ ਦੇ ਜਨਕ ਤੌਰ ਤੇ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਵਜੋਂ ਤੋਂ ਹਟਾਉਣ ਦਾ ਵਾਅਦਾ ਕੀਤਾ ਅਤੇ ਦਰਜਨਾਂ ਅਸਹਿਜ ਵਿਧਾਇਕ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਸਮਰੱਥ ਦਿੱਤਾ ਸੀ ਇਸੇ ਵਿਵਾਦ ਨੇ ਨਵੀਂ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਕੇਂਦਰੀ ਕਮਾਂਡ ਦੀ ਦਖਲ ਅੰਦਾਜੀ ਨੂੰ ਵੇਖਦਿਆਂ ਹੋਇਆ ਸੋਨੀਆ ਗਾਂਧੀ ਨੇ ਗੱਲਬਾਤ ਵਿੱਚ ਹਿੱਸਾ ਲਿਆ ਸ਼ੁਰੂ ਵਿੱਚ ਭੱਠਲ ਦੀ ਅਗਵਾਈ ਵਾਲੇ ਅਹਿਮੀਅਤ ਸਮੂਹ ਨੇ ਸਿੰਘ ਨੂੰ ਹਟਾਉਣ ਤੋਂ ਇਲਾਵਾ ਕਿਸੇ ਵੱਲ ਨੂੰ ਰੱਦ ਕਰ ਦਿੱਤਾ